ਪੰਜਾਬ ਵਿੱਚ ਕਿਸਾਨ ਆਪਣੀਆਂ ਫ਼ਸਲਾਂ ਨੂੰ ਮੁੱਖ ਤੋਰ ਤੇ ਸਰਕਾਰੀ ਮੰਡੀਆਂ ਜਿਨ੍ਹਾਂ ਨੂੰ ਅਨਾਜ ਮੰਡੀ ਵੀ ਕਿਹਾ ਜਾਂਦਾ ਹੈ ਵਿੱਚ ਵੇਚਦੇ ਹਨ ਇੱਥੇ ਸਰਕਾਰ ਵੱਲੋਂ ਨਿਯਮਤ ਕੀਮਤਾਂ ਤੇ ਉਨ੍ਹਾਂ ਦੀ ਫ਼ਸਲ ਦੀ ਖ਼ਰੀਦ ਕੀਤੀ ਜਾਂਦੀ ਹੈ ਇਸ ਪ੍ਰਕਿਰਿਆ ਵਿੱਚ ਵਿਚੋਲੇ ਵਪਾਰੀ ਵੀ ਸ਼ਾਮਿਲ ਹੁੰਦੇ ਹਨ ਜੋ ਕਿਸਾਨ ਅਤੇ ਸਰਕਾਰ ਦੇ ਵਿਚਕਾਰ ਸੌਦੇਬਾਜ਼ੀ ਕਰਦੇ ਹਨ ਹਰ ਸੂਬੇ ਵਿੱਚ ਫ਼ਸਲਾਂ ਵੇਚਣ ਦੇ ਨਿਯਮ ਅਲੱਗ ਅਲੱਗ ਹੁੰਦੇ ਹਨ ਕੁਝ ਸੂਬਿਆਂ ਵਿੱਚ ਸਰਕਾਰ ਸਿੱਧੀ ਤੋਰ ਤੇ ਕਿਸਾਨਾਂ ਤੋਂ ਫ਼ਸਲਾਂ ਦੀ ਖ਼ਰੀਦ ਕਰਦੀ ਹੈ ਜਦ ਕਿ ਹੋਰ ਥਾਵਾਂ ਤੇ ਅੜਤੀ ਪਰਾਲੀ ਵਰਤੀ ਜਾਂਦੀ ਹੈ ਇਸ ਦੇ ਨਾਲ ਹੀ ਕੁਝ ਸੂਬਿਆਂ ਵਿੱਚ ਨਿੱਜੀ ਖ਼ਰੀਦਦਾਰਾਂ ਨੂੰ ਵੀ ਫ਼ਸਲਾਂ ਖਰੀਦਣ ਦੀ ਖਰੀਦਣ ਦੀ ਅਜਾਦੀ ਹੁੰਦੀ ਹੈ ਜਿਸ ਨਾਲ ਮੁਕਾਬਲਾ ਵੱਧਦਾ ਹੈ ਅਤੇ ਕਿਸਾਨਾਂ ਨੂੰ ਚੰਗੀ ਕੀਮਤ ਮਿਲ ਜਾ ਸਕਦੀ ਹੈ ਸਰਕਾਰ ਵੱਲੋਂ ਘੱਟੋ ਘੱਟ ਸਮਰੱਥਨ ਮੁੱਲ ਨਿਰਧਾਰਿਤ ਕੀਤਾ ਜਾਂਦਾ ਹੈ ਜਿਸ ਤੋਂ ਘੱਟ ਕੀਮਤ ਦੇ ਫ਼ਸਲ ਦੀ ਖ਼ਰੀਦ ਨਹੀਂ ਕੀਤੀ ਜਾ ਸਕਦੀ ਇਹ ਨਿਯਮ ਕਿਸਾਨਾਂ ਦੇ ਆਮਦਨ ਨੂੰ ਸੁਰੱਖਿਅਤ ਕਰਨ ਲਈ ਬਣਾਏ ਜਾਂਦੇ ਹਨ ਐੱਮ ਐੱਸ ਪੀ ਅਤੇ ਹੋਰ ਨਿਯਮਾਂ ਬਾਰੇ ਵਧੇਰੇ ਜਾਣਕਾਰੀ ਵੀ ਔਨਲਾਈਨ ਵੈਬਸਾਈਟਾਂ ਤੋਂ ਮਿਲ ਜਾਂਦੀ ਹੈ ਧੰਨਵਾਦ ਜੀ